ਫੋਟੋਗ੍ਰਾਫਰੀ ਇੱਕ ਸ਼ੌਂਕ ਦੇ ਤੌਰ 'ਤੇ ਤੇ ਚੁਣਨ ਦਾ ਮੁੱਖ ਕਾਰਨ ਇਹ ਸੀ ਕੀ ਮੈਂ ਆਪਣੇ ਆਸ ਪਾਸ ਦੇ ਵਿਸ਼ਵ ਨੂੰ ਇੱਕ ਨਵੇਂ ਦ੍ਰਿਸ਼ਟੀਕੋਣ ਦੇ ਨਾਲ ਦੇਖਣਾ ਚਾਹੁੰਦਾ ਸੀ ਕੈਮਰੇ ਨਾਲ ਹਰ ਪਲ ਨੂੰ ਕੈਦ ਕਰਨ ਦਾ ਇੱਕ ਅਜੀਬ ਅਨੁਭਵ ਹੁੰਦਾ ਹੈ ਜਿਵੇਂ ਕਿ ਤੁਸੀਂ ਇੱਕ ਖ਼ਾਸ ਮੋਟੀਵੇਟਡ ਦੀ ਸਿੱ ਸਿਦਵੀ ਸਿਧਿਆਵਾਵਾਂ ਲਈ ਸਾਂਝ ਕਰ ਰਹੇ ਹੋ ਜਦੋਂ ਮੈਂ ਫੋਟੋਗ੍ਰਾਫਰੀ ਦੀ ਸ਼ੁਰੂਆਤ ਕੀਤੀ ਤਾਂ ਮੈਂ ਸਿਰਫ਼ ਦ੍ਰਿਸ਼ਟ ਦ੍ਰਿਸ਼ਟੀਆਂ ਨੂੰ ਫੜਨ ਦੇ ਲਈ ਕੈਮਰਾ ਵਰਤਿਆ ਸੀ ਪਰ ਜਿੱਥੇ ਜਿੱਥੇ ਮੇਰੀ ਯਾਤਰਾ ਵਧਦੀ ਮੈਂ ਸਮਝਿਆ ਕਿ ਹਰ ਤਸਵੀਰ ਦੇ ਪਿੱਛੇ ਕੋਈ ਕਹਾਣੀ ਛੁਪੀ ਹੋਣੀ ਹੋਈ ਹੁੰਦੀ ਹੈ ਫੋਟੋਗ੍ਰਾਫਰੀ ਨਾਲ ਸਿਰਫ਼ ਖੂਬਸੂਰਤ ਤਸਵੀਰਾਂ ਬਣਾਉਣੀਆਂ ਬਣਾਉਂਦੀ ਹੈ ਸਗੋਂ ਇਸ ਵਿੱਚ ਮਨੋਰੰਜਨ ਅਤੇ ਚਰਨਾਤਮਕ ਪ੍ਰਕਿਰਿਆ ਹੈ ਜੋ ਮਨ ਨੂੰ ਸ਼ਾਂਤ ਕਰਕੇ ਅਤੇ ਜੀਵਨ ਨੂੰ ਵੱਖ ਵੱਖ ਪਹਿਲੂਆਂ ਨੂੰ ਸਮਝਾਉਣ ਦਾ ਮੌਕਾ ਦਿੰਦੀ ਹੈ ਮੈਂ ਜਿਵੇਂ ਜਿਵੇਂ ਵਧਦਾ ਰਿਹਾ ਮੇਰੀ ਦ੍ਰਿਸ਼ਟੀ ਕਾਫ਼ੀ ਬਦਲ ਗਈ ਇਹ ਪਹਿਲਾਂ ਜਿੱਥੇ ਮੈਂ ਸਿਰਫ਼ ਪੇਸ਼ਾਵਰ ਤੌਰ 'ਤੇ ਫੋਟੋਗ੍ਰਾਫਰੀ ਵੱਲ ਧਿਆਨ ਦਿੱਤਾ ਧਿਆਨ ਨਹੀਂ ਦਿੱਤਾ ਤਾਂ ਦਿੱਤਾ ਸੀ ਹੁਣ ਇਹ ਮੇਰੀ ਮੇਰੇ ਲਈ ਸਿਰਫ਼ ਇੱਕ ਸ਼ੌਂਕ ਹੀ ਨਹੀਂ ਬਲ ਕਿ ਇੱਕ ਜੀਵਨ ਦੀ ਦ੍ਰਿਸ਼ਟੀਕੋਣ ਨੂੰ ਸਮਝਣ ਦਾ ਤਰੀਕਾ ਬਣ ਗਿਆ ਇਸ ਲਈ ਸਿੱਖਿਆ ਵਿੱਚ ਫੋਟੋਗ੍ਰਾਫਰੀ ਦੇ ਜ਼ਰੀਏ ਮੈਂ ਆਪਣੇ ਆਪ ਨੂੰ ਅਤੇ ਆਪਣੇ ਆਸ ਪਾਸ ਦੇ ਲੋਕਾਂ ਨੂੰ ਬਿਹਤਰ ਤਰੀਕੇ ਦੇ ਨਾਲ ਸਮਝਾ ਸਕਦਾ ਹਾਂ ਜਦੋਂ ਕਿ ਤੁਸੀਂ ਦਿਸ਼ਾ ਦਿਸ਼ਾ ਤੋਂ ਤਸਵੀਰਾਂ ਲੈਂਦੇ ਹੋ ਤਾਂ ਤੁਸੀਂ ਬਹੁਤ ਕੁਝ ਦੇਖਦੇ ਹੋ ਅਤੇ ਹਰ ਇੱਕ ਦ੍ਰਿਸ਼ਟੀ ਨੂੰ ਆਪਣ ਆਪਣੀ ਇੱਕ ਅਹਿਮੀਅਤ ਹੁੰਦੀ ਹੈ ਇਸ ਤਰੀਕੇ ਦੇ ਨਾਲ ਫੋਟੋਗ੍ਰਾਫਰੀ ਮੈਨੂੰ ਖੁਦ ਨੂੰ ਬਿਆਨ ਕਰਨ ਦਾ ਇੱਕ ਵਧੀਆ ਢੰਗ ਤਰੀਕਾ ਮਿਲਿਆ